ਮੇਰੇ ਖ਼ਿਆਲ ਵਿੱਚ ਆਧੁਨਿਕ ਸੰਸਾਰ ਵਿੱਚ ਪੰਜਾਬੀ ਭਾਸ਼ਾ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਹੀ ਪਰਿਵਾਰ ਆਪਣੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਪਾਉਣਾ ਵਧੇਰੇ ਪਸੰਦ ਕਰ ਰਹੇ ਹਾਂ ਸੋ ਸਾਡੇ ਬੱਚੇ ਜਿਹੜੀ ਉਹਨਾਂ ਨੂੰ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਆ ਉਹ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਦਿੱਤੀ ਹੀ ਨਹੀਂ ਜਾਂਦੀ ਅਸੀਂ ਉਹਨਾਂ ਨੂੰ ਛੋਟੇ ਹੁੰਦੇ ਹੀ ਊੜਾ ਆੜਾ ਜਾਂ ਪੰਜਾਬੀ ਦੀ ਗਿਣਤੀ ਨਹੀਂ ਸਿਖਾਉਂਦੇ ਅਸੀਂ ਉਹਨਾਂ ਨੂੰ ਏ ਫੋਰ ਐਪਲ ਕੈਟ ਰੈਟ ਇਹ ਸਿੱਖਿਆ ਦਿੱਤੀ ਜਾਂਦੀ ਆ ਉਹਨਾਂ ਨੂੰ ਸੋ ਉਹਨਾਂ ਨੂੰ ਪਹਿਲਾਂ ਹੀ ਲੱਗਣ ਲੱਗ ਜਾਂਦਾ ਹੈ ਕਿ ਜੇ ਉਹ ਇੰਗਲਿਸ਼ ਦੇ ਵਿੱਚ ਗੱਲ ਕਰਨਗੇ ਅੰਗਰੇਜ਼ੀ ਦੇ ਵਿੱਚ ਗੱਲ ਕਰਨਗੇ ਤਾਂ ਉਹ ਵਧੇਰੇ ਪਸੰਦ ਕੀਤੇ ਜਾਣਗੇ ਇਸੇ ਕਰਕੇ ਸਾ ਜੇ ਆਪਾਂ ਆਲੇ ਦੁਆਲੇ ਵਿੱਚ ਵੀ ਦੇਖੀਏ ਜਿਹੜੇ ਲੋਕ ਪੰਜਾਬੀ ਬੋਲਦੇ ਹਨ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ਼ ਅਨਪੜ੍ਹ ਮੰਨਿਆਂ ਜਾਂਦਾ ਹੈ ਸੋ ਜੇ ਸਾਡੇ ਬੱਚਿਆਂ ਦੇ ਕੋਲ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਹੈ ਜੇ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਹੀ ਨਿਪੁੰਨ ਨਹੀਂ ਹਾਂ ਤਾਂ ਅਸੀਂ ਕਿਸੇ ਹੋਰ ਭਾਸ਼ਾ ਨੂੰ ਵੀ ਚੰਗੀ ਤਰ੍ਹਾਂ ਸਿੱਖ ਨਹੀਂ ਸਕਦੇ ਇਹੀ ਕਾਰਨ ਹਨ ਸਾਡੀ ਪੰਜਾਬੀ ਭਾਸ਼ਾ ਦੇ ਪਛੜਣ ਦੇ